ਕੀ ਹਾਲ ਆ ਮਨਦੀਪ ਵੀਰੇ ਬਸ ਵਧੀਆ ਜੀ ਵਧੀਆ ਹੋਰ ਕੀ ਕਰਦੇ ਸੀਗੇ ਜੀ ਅੱਛਾ ਅੱਛਾ ਹੋਰ ਘਰ ਠੀਕ ਨੇ ਸਾਰੇ ਬਸ ਵਧੀਆ ਜੀ ਵਧੀਆ ਹੋਰ ਵੀਰੇ ਪੜ੍ਹਾਈ ਪੜੂਈ ਲੱਗੀਏ ਕਰਨ ਅੱਗੇ ਆਪਾਂ ਕਿਤੇ ਹਾਂਜੀ ਹਾਂਜੀ ਉਹ 'ਤੇ ਦੇਖ ਲੈਂਦੇ ਆ ਬਟ ਯਾਰ ਵੀਰੇ ਉੱਧਰ ਯਾਰ ਇੱਕ ਤਾਂ ਦੂਰ ਪੈਣੀ ਆ ਯਾਰ ਉਹ ਹਾਂ ਇੱਕ ਤੁਹਾਨੂੰ ਪਤਾ ਸਾਧਨ ਦਾ ਵੀ ਔਖਾ ਯਾਰ ਉੱਧਰ ਨੂੰ ਜਾਣਾ ਇੱਕ ਮਿੱਟੀ ਘੱਟਾ ਬਹੁਤ ਉੱਧਰ ਨੂੰ ਯਾਰ ਟਰੈਫਿਕ ਬਹੁਤ ਹੈ

ਮੈਂ ਤਾਂ ਮੈਂ ਤਾਂ ਵੀਰੇ ਇੱਧਰ ਦੀ ਸੋਚ ਰਿਹਾ ਵੀ ਫਤਿਹਗੜ੍ਹ ਸਾਹਿਬ ਆਪਾਂ ਦੇਖ ਲੈਂਨੇ ਆ ਕਿਧਰੇ ਯੂਨੀਵਰਸਿਟੀ 'ਚ ਆਪਣੇ ਹਾਂ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਵਰਡ ਯੂਨੀਵਰਸਿਟੀ ਹੈ ਨਹੀਂ ਇੱਧਰ ਹਾਂਜੀ ਹਾਂਜੀ ਹਾਂਜੀ ਉਹ 'ਚ ਆਪਾਂ ਟਰਾਈ ਕਰ ਲੈਂਨੇ ਜਾ ਕੇ ਮੈਂ ਕਹਿੰਦਾ ਉਹ 'ਚ ਨਾਲੇ ਫੀਸ ਵੀ ਘੱਟ ਆ ਯਾਰ ਹਾਂਜੀ ਹਾਂਜੀ ਹਾਂਜੀ ਹਾਂ ਉੱਥੇ ਉਹ ਆਪਾਂ ਨਾਲੇ ਨ ਨੂੰ ਨੇੜੇ ਪਵੇਗੀ ਅਤੇ ਨਾਲੇ ਆਪਣੇ ਆਪਾਂ ਇ ਇੱਧਰੋਂ ਜਿਹੜੀ ਪਿੰਡੋਂ ਬੱਸ ਜਾਂਦੀ ਹੈ ਨਾ ਆਪਾਂ ਉਹਦੇ ਵਿੱਚ ਚਲੇ ਜਾ ਕਰਾਂਗੇ ਉਹਦੇ ਵਿੱਚ ਆ ਜਾ ਕਰਾਂਗੇ ਹਾਂਜੀ ਹਾਂ ਆਪਾਂ ਬੀ ਏ ਦੇ ਬੀ ਏ ਕਰ ਲਾਂਗੇ ਨਾ ਬੀ ਏ ਬਾਕੀ ਹਾਂਜੀ ਬਾਕੀ ਤੁਸੀਂ ਦੱਸੋ ਜਿਵੇਂ

ਹਾਂਜੀ ਹਾਂਜੀ ਹਾਂਜੀ ਹਾਂਜੀ ਉੱਥੇ ਫੀਸ ਵੀ ਕਹਿੰਦੇ ਤਿੰਨ ਕੁ ਹਜ਼ਾਰ ਏ ਆ ਬਾਕੀ ਉਹ ਤੋਂ ਬਾਅਦ ਥੋੜ੍ਹੀ ਬਹੁਤੇ ਲੈਣਗੇ ਹੋਰ ਹਾਂਜੀ ਹਾਂਜੀ ਹਾਂਜੀ ਚਲੋ ਚਲੋ ਹਾਂਜੀ ਹਾਂਜੀ ਆਹੋ ਆ ਜਾਂਗੇ ਆਪਾਂ ਫਿਰ ਆਪਾਂ ਲੱਗ ਜਾਂਗੇ ਹਾਂਜੀ ਹਾਂਜੀ ਸਹੀ ਗੱਲ ਹੈ ਚਲੋ ਕਿਸੇ ਦਿਨ ਵਿਹਲੇ ਹੋਗੇ ਆਪਾਂ ਵੈਹੇ ਚਲੋ ਤੁਸੀਂ ਇਕੱਲੇ ਹੀ ਕਹਿਤਾ ਆਪਾਂ ਜਾ ਆਉਂਦੇ ਸਵੇਰੇ ਆਪਾਂ ਗੱਲਬਾਤ ਕਰਕੇ ਫਿਰ ਲੱਗ ਜਾਂਗੇ ਠੀਕ ਹੈ ਵੀਰੇ ਠੀਕ ਓਕੇ ਓਕੇ ਵੀਰੇ